ਮੈਂ ਯੋਗਾ ਹਰ ਰੋਜ਼ ਕਰ ਸਵੇਰੇ ਉੱਠ ਕੇ ਕਰਦੀ ਹਾਂ ਯੋਗੇ ਦੇ ਮੈਨੂੰ ਬਹੁਤ ਫਾਇਦੇ ਹਨ ਇਸ ਕਰਕੇ ਮੈਂ ਦਿਨ ਵਿੱਚ ਦੋ ਦੋ ਵਾਰ ਵੀ ਯੋਗਾ ਕਰ ਲੈਂਦੀ ਹਾਂ ਸੁਬਹਾ ਟਾਇਮ ਲੱਗਦਾ ਸੁਬਹਾ ਸਵੇਰੇ ਵੀ ਦੋ ਟਾਈਮ ਯੋਗਾ ਕਰਦੀ ਹਾਂ ਜੋ ਕਿ ਇਸ ਲਈ ਮੈਨੂੰ ਬਹੁਤ ਆਰਾਮ ਹੈ ਮੈਂ ਪਾਰਕ ਵਿੱਚ ਵੀ ਸਹੇਲੀਆਂ ਨਾਲ ਜਾ ਕੇ ਯੋਗਾ ਕਰਦੀ ਹਾਂ ਮੈਂ ਇਸ ਯੋਗੇ ਕਰਕੇ ਮੈਨੂੰ ਬਹੁਤ ਅ ਅਰਾਮ ਮਹਿਸੂਸ ਹੁੰਦਾ ਹੈ ਮੇਰੇ ਵਿੱਚ ਖੂਨ ਦੀ ਬਹੁਤ ਕਮੀ ਸੀ ਇਸ ਲਈ ਮੈਨੂੰ ਖੂਨ ਦਾ ਮੇਰਾ ਖੂਨ ਵੀ ਬਹੁਤ ਸਹੀ ਹੈ ਮੈਂ ਆਪ ਵੀ ਕਰਦੀ ਹਾਂ ਆਪਦੇ ਆਂਢ ਗਵਾਂਢ ਨੂੰ ਵੀ ਯੋਗਾ ਕਰਵਾਉਂਦੀ ਹਾਂ ਇਸ ਕਰਕੇ ਸਾਰੇ ਅਸੀਂ ਤੰਦਰੁਸਤ ਹਾਂ ਮੇਰੇ ਵਿੱਚ ਮੇਰੇ ਸਿਰ ਦਰਦ ਵਿੱਚ ਬਹੁਤ ਪ੍ਰੋਬਲਮ ਸੀਗੀ ਇਸ ਯੋਗਾ ਕਰਕੇ ਮੈਂ ਸਹੀ ਹੁਣ ਮੈਂ ਸਹੀ ਰਹਿੰਦੀ ਹਾਂ ਮੈਂ ਬਹੁਤ ਜ਼ਿਆਦਾ ਆਰਾਮ ਮਹਿਸੂਸ ਕਰਦੀ ਹਾਂ ਮੇਰੇ ਆਂਡ ਗਵਾਂਡ ਵਿੱਚ ਕਿਸੇ ਨੂੰ ਬੀਪੀ ਦੀ ਸ਼ਿਕਾਇਤ ਸੀ ਉਸਨੂੰ ਵੀ ਯੋਗਾ ਕਰਾ ਕੇ ਉਹਦਾ ਵੀ ਬੀਪੀ ਸਹੀ ਰਹਿੰਦਾ ਹੈ ਕਿਸੇ ਨੂੰ ਸ਼ੂਗਰ ਸੀਗਾ ਉਹ ਸੂਗਰ ਨਾਲ ਵੀ ਬਹੁਤ ਸਹੀ ਆਰਾਮ ਹੈ ਉਹਨਾਂ ਨੂੰ ਇਸ ਕਰਕੇ ਮੈਂ ਰੋਜ਼ ਯੋਗਾ ਕਰਦੀ ਹਾਂ ਕਰਵਾਉਂਦੀ ਵੀ ਹਾਂ ਇਸ ਯੋਗੇ ਦੇ ਬਹੁਤ ਫਾਇਦੇ ਹੁੰਦੇ ਹਨ ਮੇਰਾ ਯੋਗੇ ਨਾਲ ਬਹੁਤ ਮੈਂ ਯੋਗੇ ਨਾਲ ਬਹੁਤ ਸੰਬੰਧ ਰੱਖਦੀ ਹਾਂ ਇਸ ਕਰਕੇ ਮੇਰਾ ਯੋਗਾ ਦਿਨ ਦੋ ਦੋ ਟਾਈਮ ਚੱਲ ਰਿਹਾ ਹੈ ਯੋਗੇ ਕਰਕੇ ਬਹੁਤ ਆਰਾਮ ਮਹਿਸੂਸ ਹੁੰਦਾ ਹੈ ਮੇਰੇ ਆ ਪੜੋਸੀਆਂ ਨੂੰ ਬਹੁਤ ਜ਼ਿਆਦਾ ਤਕਲੀਫ ਸੀ ਯੋਗਾ ਕਰਨ ਨਾਲ ਉਹ ਸਭ ਸਹੀ ਹਨ ਇਸ ਕਰਕੇ ਮੈਂ ਯੋਗਾ ਬਹੁਤ ਜ਼ਿਆਦਾ ਕਰਦੀ ਹਾਂ ਮੈਂ ਕਰਵਾਉਂਦੀ ਵੀ ਹਾਂ ਮੇਰੇ ਸਾਰੇ ਆਂਢ ਗਵਾਂਢ ਸਭ ਤੰਦਰੁਸਤ ਹਨ ਇਸ ਕਰਕੇ ਯੋਗਾ ਸਹੀ ਚੱਲ ਰਿਹਾ ਹੈ